ਟ੍ਰੈਡਮਿਲ ਨੂੰ ਵਰਤਣ ਦੀ ਵਿਚਾਰ ਕਰਦਿਆਂ ਮੈਨੂੰ ਲੱਗਦਾ ਹੈ ਕਿ ਟ੍ਰੈਡਮਿਲ 'ਤੇ ਕੰਮ ਕਰਨਾ ਅਤੇ ਜ਼ਮੀਨ 'ਤੇ ਦੌੜਨ ਨਾਲ ਇੱਕ ਨਾਲ ਮੁਕਾਬਲਾ ਨਹੀਂ ਹੈ ਕਿਉਂਕਿ ਟ੍ਰੈਡਮਿਲ ਦੁਆਰਾ ਕੰਮ ਕਰਨਾ ਆਮ ਤੌਰ 'ਤੇ ਬੈਠੇ ਰਹਿਣ ਨੂੰ ਸ਼ਾਮਿਲ ਕਰਦਾ ਹੈ ਜਦ ਕਿ ਜ਼ਮੀਨ 'ਤੇ ਦੌੜਨਾ ਫਿਜ਼ੀਕਲ ਐਕਟੀਵਿਟੀ ਹੈ ਜੋ ਸਰੀਰਿਕ ਤੌਰ 'ਤੇ ਹੋਣੀ ਚਾਹੀਦੀ ਹੈ ਟ੍ਰੈਡਮਿਲ ਇੱਕ ਸਧਾਰਨ ਫਿਟਨੈਸ ਉੱਪਰ ਉਪ ਉਪਕਰਨ ਹੈ ਜੋ ਲੋਕਾਂ ਦੇ ਘਰ ਵਿੱਚ ਵਰਤਣ ਦੀ ਇਜਾਜ਼ਤ ਦਿੰਦੀ ਹੈ ਇਸ ਵਿੱਚ ਚੱਲਦੇ ਰਹਿਣ ਦੀ ਵਧੇਰੇ ਤਕਨੀਕ ਵਿਵਸਥਾ ਹੈ ਜੋ ਵਿਅਕਤੀ ਦੀ ਪਸੰਦ ਅਤੇ ਲਿਖਕਤ ਸੰਘਰਸ਼ ਦੀ ਪੁਰਸਕਾਰ ਕਰਨ ਵਿਚ ਮਦਦ ਕਰਦੀ ਹੈ ਕਈ ਲੋਕ ਵਿਦਿਆਰਥੀਆਂ ਕਰਨ ਵਾਲੇ ਲੋਕ ਅਜਿਹਾ ਹੀ ਅਜਿਹਾ ਇੱਕ ਇਸ ਇਸ ਪਾਥ ਹੋਟਲ ਦੀ ਸੁਰੱਖਿਆ ਤੋਂ ਹੋਰ ਲੋਕ ਸ ਸਰੀਰ ਵਰਤਦੇ ਹਨ ਤਾਂ ਉਹ ਘਰ ਵਿਚ ਵੀ ਆਰਾਮ ਨਾਲ ਅਭਿਆਸ ਕਰ ਸਕਣ ਟ੍ਰੈਡਮਿਲ ਵਰਤਣ ਦਾ ਲਾਭ ਇਹ ਹੈ ਕਿ ਤੁਹਾਨੂੰ ਸੁਖ ਸਮੇਂ ਰਹੋਈ ਦੀ ਅਵਸਥਾ ਵਿੱਚ ਫਿਟਨੈਸ ਉਪਕਰਨ ਦੀ ਸੁਵਿਧਾ ਮਿਲਦੀ ਹੈ ਇਹ ਬੇਬਾਕੀ ਕਸਰਤ ਸ਼ੁਰੂ ਕਰਨ ਵਾਲੇ ਲੋਕਾਂ ਦੀ ਕਈ ਵੀ ਕਈਆਂ ਲਈ ਵੀ ਉਪਯੋਗੀ ਹੈ ਜਿਹਨਾਂ ਦਾ ਸਮੇਂ ਅਤੇ ਪੈਸੇ ਦਾ ਮਾਮਲਾ ਹੈ ਜੋ ਸਮੇਂ ਬੀਤਣ ਕਾਰਨ ਕੈਲਰੀ ਗਿਣੇ ਵਾਲੀ ਵਿਲਕਮ ਨਹੀਂ ਹੁੰਦੀ ਇਸ ਵਿਦਿਆਰਥੀ ਜ਼ਿਆਦਾ ਸੰਘਰਸ਼ ਨਹੀਂ ਕਰਦੇ ਪਿਓ 'ਤੇ ਸਿਰ ਤੋਂ ਨਿੱਜੀ ਤੌਰ 'ਤੇ ਅਭਿਆਸ ਕਰਨ ਵਾਲੇ ਲੋਕਾਂ ਲਈ ਵੀ ਇਸ ਇਸ ਪਾਤ ਨੂੰ ਵਰਤਣਾ ਵਰਤਣਾ ਹੋਰ ਮਿਆਰ ਹੈ